ਮੈਨੂੰ ਹੁਣ ਤੱਕ ਯਾਦ ਹੈ ਕਿ ਸਾਡੇ ਮਾਤਾ ਪਿਤਾ ਨੇ ਪਸ਼ੂ ਰੱਖੇ ਸਨ ਚਾਰ ਮੱਝਾਂ ਸੀਗੀਆਂ ਸਾਡੇ ਕੋਲ ਜਿਨ੍ਹਾਂ ਦੀ ਦੇਖਭਾਲ ਉਹ ਦਿਨ ਭਰ ਕਰਦੇ ਸੀਗੇ ਪਸ਼ੂ ਕਹਿਣ ਨੂੰ ਪਸ਼ੂ ਹੁੰਦੇ ਲੇਕਿਨ ਉਹਨਾਂ ਨੂੰ ਰੱਖਣਾ ਬੱਚਿਆਂ ਵਾਂਗੂੰ ਪੈਂਦਾ ਹੈ ਸਵੇਰੇ ਉੱਠ ਕਰ ਮਾਤਾ ਪਿਤਾ ਸਾਡੇ ਉਹਨਾਂ ਦੁਆਲੇ ਲੱਗ ਜਾਂਦੇ ਸੀਗੇ ਸਵੇਰੇ ਉੱਠ ਕੇ ਉਹਨਾਂ ਨੂੰ ਪੱਠੇ ਪਾਉਣੇ ਪਾਣੀ ਪ ਪਿਲਾਉਣਾ ਦਿਨ ਭਰ ਉਹਨਾਂ ਦੀ ਸੇਵਾ ਕਰਨੀ ਅਤੇ ਉ ਉਹਨਾਂ ਨੂੰ ਜੇ ਤਾਂ ਸਿਆਲ ਹੋਣ ਤਾਂ ਧੁੱਪੇ ਰ ਖ ਖੜ੍ਹੇ ਕਰਨਾ ਪੈਂਦਾ ਸੀਗਾ ਉਹਨਾਂ ਨੂੰ ਉੱਥੇ ਬਿਠਾਉਂਦੇ ਸੀਗੇ ਧੁੱਪੇ ਜਿੱਥੇ ਉਹ ਰਹਿੰਦੇ ਹੈ ਉੱਥੇ ਦੀ ਸਾਫ਼ ਸਫਾਈ ਕਰਨੀ ਗੋਹਾ ਚੱਕਣਾ ਸ਼ੈਡ ਨੂੰ ਪੂਰਾ ਇਕਦਮ ਸਾਫ਼ ਰੱਖਣਾ ਸਾਰਾ ਦਿਨ ਯਾਨੀ ਉਹ ਲੱਗੇ ਰਹਿੰਦੇ ਸੀਗੇ ਮੈਂ ਕਦੀ ਬੈਠੇ ਨਹੀਂ ਦੇਖੇ ਸੀਗੇ ਜਦ ਤੱਕ ਸਾਡੇ ਕੋਲ ਪਸ਼ੂ ਸਨ ਅਤੇ ਦੁਪਹਿਰ ਨੂੰ ਫਿਰ ਉਹਨਾਂ ਨੂੰ ਪੱਠੇ ਪਾਉਣੇ ਉਹਨਾਂ ਨੂੰ ਦੋ ਤਿੰਨ ਵਜੇ ਫਿਰ ਪਾਣੀ ਪਿਲਾਉਣਾ ਸ਼ਾਮ ਨੂੰ ਫਿਰ ਉਹਨਾਂ ਦੀ ਸੇਵਾ ਕਰਨੀ ਫਿਰ ਧਾਰਾਂ ਕੱਢਣੀਆਂ ਜੇ ਕਿਤੇ ਉਹ ਬਿਮਾਰ ਹੋ ਜਾਣ ਸਾਨੂੰ ਡੋਕਟਰ ਨੂੰ ਬੁਲਾਉਣਾ ਪੈਂਦਾ ਸੀ ਟੀਕੇ ਵਗੈਰਾ ਲਾਉਣੇ ਪੈਂਦੇ ਸੀਗੇ ਅਤੇ ਕਾਫ਼ੀ ਯਾਨੀ ਸੰਘਰਸ਼ ਕਰਨਾ ਪੈਂਦਾ ਹੈ ਜੇ ਕਦੇ ਪਸ਼ੂ ਨੂੰ ਰੱਖਿਆ ਹੋਵੇ ਅਸੀਂ ਅੱਜ ਕੱਲ੍ਹ ਤਾਂ ਜਿਹੜੇ ਬਿਜਨਸਮੈਨ ਨੇ ਜਿਹੜੇ ਡੇਅਰੀਆਂ 'ਚ ਦੁੱਧ ਵਗੈਰਾ ਪਾਉਂਦੇ ਨੇ ਉਹੀ ਪਸ਼ੂ ਰੱਖਦੇ ਹਨ ਸ਼ਹਿਰਾਂ ਵਿੱਚ ਤਾਂ ਇਹਨਾਂ ਦਾ ਰਿਵਾਜ ਹੀ ਚਲਾ ਗਿਆ ਵਾ ਹੁਣ ਤਾਂ ਅਸੀਂ ਵੀ ਯਾਨੀ ਮੁੱਲ ਦਾ ਦੁੱਧ ਲੈ ਕੇ ਹੀ ਗੁਜ਼ਾਰਾ ਕਰਦੇ ਹਾਂ ਹੁਣ ਤਾਂ ਮੱਝਾਂ ਰੱਖਣੀਆਂ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ